ਪੰਜਾਬੀ ਭਾਸ਼ਾ ਬ੍ਰਹਿਮੀ ਲਿਪੀ 'ਚੋਂ ਉਪਜੀ ਹੈਗੀ ਹੈ ਜਿਹੜੀ ਬ੍ਰਹਿਮੀ ਲਿਪੀ ਹੈ ਇਹਦੇ ਵਿੱਚੋਂ ਹੋਰ ਭਾਸ਼ਾਵਾਂ ਵੀ ਉਪਜੀਆਂ ਹੋਈਆਂ ਜਿੱਦਾਂ ਹੁਣ ਹੈਗੀ ਹੈ ਦੇਵਨਾਗਰੀ ਹੈ ਦੇਵਨਾਗਰੀ 'ਚੋਂ ਬਣੀ ਹੈਗੀ ਹੈ ਹਿੰਦੀ ਭਾਸ਼ਾ ਜਿਹੜੀ ਬ੍ਰਹਿਮੀ ਲਿਪੀ ਤੋਂ ਅੱਗੇ ਬਣੀ ਹੈਗੀ ਹੈ ਗੁਰਮੁਖੀ ਗੁਰਮੁਖੀ ਤੋਂ ਬਣੀ ਹੈਗੀ ਹੈ ਪੰਜਾਬੀ ਭਾਸ਼ਾ ਜਿਹੜੀ ਪੰਜਾਬੀ ਭਾਸ਼ਾ ਦੇ ਜਿਹੜਾ ਇਹਨੂੰ ਤਰਤੀਬਵਾਰ ਲਿਖਣ 'ਚ ਜਿਹੜੇ ਸਿੱਖਾਂ ਦੇ ਦੂਜੇ ਗੁਰੂ ਆਏ ਹੋਏ ਹੈਗੇ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੀ ਪੰਜਾਬੀ ਭਾਸ਼ਾ ਏ ਇਹ ਰੀਜ਼ਨ ਵਾਈਸ ਹੈ ਜਾਂ ਕਹਿ ਲਓ ਅੱਪਾਂ ਖੇਤਰ ਵਾਈਸ ਕਹਿ ਲਓ ਥੋੜ੍ਹੇ ਜਿਹੇ ਖੇਤਰ 'ਤੇ ਦਸ ਕਿਲੋਮੀਟਰ ਕਹਿ ਲਓ ਵੀਹ ਕਿਲੋਮੀਟਰ ਕਹਿ ਲਓ ਇਹਦੇ ਬਾਅਦ ਇਹਦਾ ਜਿਹੜਾ ਬੋਲਣ ਦਾ ਰੰਗ ਢੰਗ ਹੈ ਅਤੇ ਸ਼ਬਦਾਂ ਦਾ ਏ ਉਹ ਹੇਰ ਫੇਰ ਹੈ ਉਹ ਥੋੜ੍ਹੇ ਜੇ ਖੇਤਰ ਤੋਂ ਬਾਅਦ ਸਾਨੂੰ ਦੇਖ ਚੇਂਜ ਮਿਲਦਾ ਹੈਗਾ ਏ ਅਲੱਗ ਦੇਖਣ ਨੂੰ ਮਿਲਦਾ ਹੈਗਾ ਸਾਨੂੰ ਖੇਤਰ ਵਾਈਜ਼ ਉਹ